ਹੈਲੋ ਅਸੀਂ ਨਾ ਰਾਤ ਦੇ ਪ੍ਰੋਗਰਾਮ 'ਤੇ ਗਏ ਸੀ ਸਾਰੇ ਪਰਿਵਾਰ ਸਮੇਤ ਅਤੇ ਅਸੀਂ ਘਰ ਵਾਪਸ ਆਉਣਾ ਸੀਗਾ ਅਤੇ ਅਸੀਂ ਨਾ ਕਿਸੇ ਡਰਾਈਵਰ ਨੂੰ ਬੁਲਾਇਆ ਸੀਗਾ ਉਹ ਹਜੇ ਤੱਕ ਆਇਆ ਨਹੀਂ ਗਾ ਅਤੇ ਟਾਈਮ ਵੀ ਇੰਨਾ ਹੋ ਚੁੱਕਿਆ ਹੈ ਕਿ ਅਸੀਂ ਕਿਸੇ ਦੂਸਰੇ ਬੰਦੇ ਨੂੰ ਡਰਾਈਵਰੀ ਕਰਕੇ ਅਸੀਂ ਬੁਲਾ ਨਹੀਂ ਸਕਦੇ ਗੇ ਅਤੇ ਇੰਨੇ ਰਸਤੇ ਤੱਕ ਅਸੀਂ ਘਰ ਜਾ ਵੀ ਨਹੀਂ ਸਕਦੇ ਅਤੇ ਇੰਨੀ ਰਾਤ ਨੂੰ ਇਸ ਕਰਕੇ ਅਸੀਂ ਸੋਚਿਆ ਚਲੋ ਡਰਾਈਵਰ ਨੂੰ ਹੀ ਫੋਨ ਕਰਕੇ ਬੁਲਾ ਲਈਏ ਪਰ ਉਹਦੀ ਲੋਕੇਸ਼ਨ ਦੇ ਅਨੁਸਾਰ ਅਤੇ ਉਹ ਆਇਆ ਹੀ ਨਹੀਂ ਹਜੇ ਤੱਕ